ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਹਾਂਜੀ ਦੱਸੋ ਅੱਜ ਅਸੀਂ ਇੱਥੇ ਇਹ ਗੁਰੂ ਗੋਬਿੰਦ ਸਿੰਘ ਨਗਰ ਦੇ ਵਿੱਚ ਆਏ ਹੋਏ ਹਾਂ ਅਸੀਂ ਮਾਨਸਾ ਹਾਂਜੀ ਤੁਸੀਂ ਦੱਸੋ ਤੁਹਾਡੀਆਂ ਮਤਲਬ ਕੀ ਕੀ ਤੁਹਾਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਮੈਡਮ ਦੇਖੋ ਅਸੀਂ ਮਤਲਬ ਪੂਰਾ ਕੋਸ਼ਿਸ਼ ਕਰ ਰਹੇ ਹਾਂ ਦੇਖੋ ਹੁਣ ਬਾਕੀ ਤੁਹਾਨੂੰ ਵੀ ਪਤਾ ਵੀ ਥੋੜ੍ਹਾ ਜਿਹਾ ਵੋਟਾਂ ਦਾ ਉਹ ਚੱਲ ਰਿਹਾ ਵੀ ਹੁਣ ਪ੍ਰਸ਼ਾਸਨ ਥੋੜ੍ਹਾ ਜਿਹਾ ਮਤਲਬ ਉੱਧਰ ਬੀਜੀ ਹੈ ਵੀ ਹੁਣ ਕੋਈ ਫੰਡ ਫੁੰਡ ਅੱਗੇ ਨਹੀਂ ਪਾਸ ਹੋ ਰਹੇ ਹੈਗੇ ਅਤੇ ਮੈਡਮ ਕੋਈ ਗੱਲ ਨਹੀਂ ਅਸੀਂ ਜ਼ਰੂਰ ਤੁਹਾਡਾ ਮਤਲਬ ਸੁਣਾਂਗੇ ਮਤਲਬ ਹਾਂਜੀ ਹੋਰ ਇਸ ਤੋਂ ਇਲਾਵਾ ਕੋਈ ਹੋਰ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂ ਮੈਡਮ ਉਹ ਹਾਂਜੀ ਹਾਂਜੀ ਦੇਖੋ ਉਹਦੇ ਲਈ ਤਾਂ ਆਪਣੀ ਮਤਲਬ ਫੁੱਲ ਪੂਰੀ ਦੇਖੋ ਤਿਆਰ ਬਰ ਤਿਆਰ ਹੈ ਚੌਵੀ ਘੰਟੇ ਤੁਹਾਡਾ ਮਾਨਸਾ ਮੈਨੂੰ ਲੱਗਦਾ ਡੀ ਸੀ ਦਫ਼ਤਰ ਦੇ ਵਿੱਚੋਂ ਉਹ ਆਪਣੇ ਹਰ ਜਗ੍ਹਾ ਅੱਜ ਕੱਲ ਉਹ ਵੀ ਲੱਗੇ ਹੁੰਦੇ ਨੇ ਬੋਡ ਵੀ ਐਨੇ ਨੰਬਰ 'ਤੇ ਡਾਇਲ ਕਰੋ ਤੁਸੀਂ ਦੇਖੋ ਆਪਦੇ ਇਲਾਕੇ ਦੇ ਵਿੱਚ ਤੁਸੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਹੋ ਇਹਦੇ ਬਾਰੇ ਹੈ ਨਾ ਥੋੜ੍ਹਾ ਜਿਹਾ ਦੇਖੋ ਵੀ ਪੁਲਿਸ ਵੀ ਤੁਹਾਨੂੰ ਪਤਾ ਪ੍ਰਸ਼ਾਸਨ ਵੀ ਸੁਣਦਾ ਹੈਗਾ ਵੀ ਦੇਖੋ ਕੋਈ ਇਹੋ ਜਿਹੀ ਤਾਂ ਗੱਲ ਹੈ ਨਹੀਂ ਵੀ ਪ੍ਰਸ਼ਾਸਨ ਸੁਣ ਨਹੀਂ ਰਿਹਾ ਤਾਂ ਅਸੀਂ ਤੁਹਾਨੂੰ ਮਤਲਬ ਹਾਂਜੀ ਹਾਂਜੀ ਹਾਂਜੀ ਨਹੀਂ ਉਹ ਤਾਂ ਦੇਖੋ ਅਸੀਂ ਮਤਲਬ ਹੁਣ ਦੇਖੋ ਮਤਲਬ ਜ਼ਰੂਰ ਦੇਖੋ ਪਿਛਲੇ ਵਾਰ ਵੀ ਤੁਸੀਂ ਸਾਨੂੰ ਜਿਤਾਇਆ ਤੁਸੀਂ ਐਨੀਆਂ ਵੋਟਾਂ ਦੇ ਕੇ ਤਾਂ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ ਹਾਂ ਦੇਖੋ ਐ ਮਤਲਬ ਐਤਕੀ ਵੀ ਦੇਖੋ ਸਾਨੂੰ ਮਤਲਬ ਪੂਰਾ ਵਿਸ਼ਵਾਸ ਆ ਦੇਖੋ ਸਾਡਾ ਈ ਟੀਮ ਪੂਰੀ ਤਿਆਰ ਬਰ ਤਿਆਰ ਆ ਤੁਹਾਡੀ ਹਰ ਹਰ ਤੁਹਾਡੀ ਪ੍ਰੋਬਲਮ ਦੇ ਨਾਲ ਨਜਿੱਠਣ ਦੇ ਲਈ ਫੇਰ ਵੀ ਚਲੋ ਤੁਸੀਂ ਅਸੀਂ ਤੁਹਾਡੀਆਂ ਜਿਹੜੀਆਂ ਦਿੱਕਤਾਂ ਤੁਸੀਂ ਕਹਿ ਰਹੇ ਹੋ ਜਿਹੜੀਆਂ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਉਹ ਦੇਖੋ ਨੋਟ ਕਰ ਲਈਆਂ ਨੇ ਤਾਂ ਜ਼ਰੂਰ ਦੇਖੋ ਅਸੀਂ ਮਤਲਬ ਸੁਣਾਂਗੇ ਤਾਂ ਬਸ ਤੁਸੀਂ ਦੇਖੋ ਵੋਟਾਂ ਦਾ ਟਾਈਮ ਹੈ ਤਾਂ ਜ਼ਰੂਰ ਤੁਸੀਂ ਦੇਖੋ ਜੇ ਤੁਹਾਨੂੰ ਲੱਗਦਾ ਵੀ ਅਸੀਂ ਹੈ ਨਾ ਚੰਗੇ ਕੰਮ ਕੀਤੇ ਨੇ ਤਾਂ ਜ਼ਰੂਰ ਤੁਸੀਂ ਸਾਨੂੰ ਇਸ ਵਾਰ ਸੇਵਾ ਦਾ ਮੌਕਾ ਦਿਉ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਜ਼ਰੂਰ ਦੇਖੋ ਅਸੀਂ ਜ਼ਰੂਰ ਤਿਆ ਮਤਲਬ ਕੋਸ਼ਿਸ਼ ਕਰਾਂਗੇ ਅਤੇ ਅਸੀਂ ਦੇਖਦੇ ਹਾਂ ਕੁਛ ਚਲੋ ਜੋ ਹੁੰਦਾ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹ